ਹੈਲੋ ਨਮਸਕਾਰ ਜੀ ਸਤਿ ਸ਼੍ਰੀ ਅਕਾਲ ਮੈਂ ਸੀਮਾ ਬੋਲਦੀ ਪਈ ਹਾਂਜੀ ਹਾਂਜੀ ਵਧੀਆ ਪਹਿਚਾਣ ਲਿਆ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਮੈਂ ਦਰਅਸਲ ਨਾ ਰਮਨ ਦਾ ਸਕੂਲ ਚੇਂਜ ਕਰਨਾ ਚਾਹੁੰਦੀ ਸੀ ਅਤੇ ਮੈਂ ਉਹਦੇ ਰਿਗਾਰਡਿੰਗ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦੀ ਸੀ ਤੁਹਾਡੇ ਬੱਚੇ ਕਿੱਥੇ ਪੜ੍ਹ ਰਹੇ ਆ

ਹਾਂ ਹਾਂ ਉੱਥੇ ਜਾਣਾ ਵੀ ਜਿਹੜਾ ਜਾਣਾ ਨਜ਼ਦੀਕੀ ਰਹੇ ਅਤੇ ਜਿਹਦੇ ਰਿਗਾਰਡਿੰਗ ਜਿਹਦੇ ਵਿੱਚ ਪੜ੍ਹਾਈ ਵੀ ਅੱਛੀ ਹੋਵੇ ਉਹੀ ਮੈਂ ਤੁਹਾਡੇ ਨਾਲ ਡਿਸਕਸ ਕਰਨੀ ਤੁਹਾਡੇ ਮਾਇੰਡ 'ਚ ਹੈਗਾ ਕੋਈ ਸਕੂਲ ਸਾਡੇ ਵੱਲ ਪੁਲਿਸ ਡੀ ਏ ਵੀ ਵੀ ਹੈਗਾ ਵਾ ਸਾਡੇ ਵੱਲ ਪੁਲਿਸ ਡੀ ਏ ਵੀ ਉੱਧਰ ਮਾਰਵਰਡ ਆਈ ਵੀ ਹੈਗੇ ਆ ਪਰ ਮੈਂ ਚਾਹੁੰਦੀ ਤੁਹਾਨੂੰ ਇਹਦੇ ਬਾਰੇ ਕੁਛ ਪਤਾ ਹਾਂ ਪਰ ਜਿਹੜੇ ਬਾਕੀ ਜਿੰਨੇ ਵੀ ਆ ਸਾਰੇ ਇੰਗਲਿਸ਼ ਮੀਡੀਅਮ ਸਕੂਲ ਸਾਰੇ ਇੰਗਲਿਸ਼ 'ਤੇ ਫੋਕਸ ਕਰਦੇ ਆ ਅਤੇ ਇਹਨਾਂ ਦੇ ਵਿੱਚ ਧਰਮ ਨਾ ਤਾਂ ਨਾ ਬੱਚਿਆਂ ਦੀ ਕਲਚਰ ਨੂੰ ਕੋਈ ਪ੍ਰਮੋਟ ਕਰਦਾ ਕੋਈ ਦੱਸਦਾ ਅਤੇ ਨਾ ਬੱਚਿਆਂ ਨੂੰ ਕੋਈ ਰਿਲੀਜਨ ਬਾਰੇ ਦੱਸਦਾ ਅਤੇ ਤੁਹਾਨੂੰ ਜੀ ਟੀ ਵੀ ਬਾਰੇ ਪਤਾ ਵਾ ਹਜ਼ਾਰੇ ਬਾਰੇ ਜਿਹੜਾ ਤੁਸੀਂ ਕਹਿੰਦੇ ਤੁਹਾਡਾ ਕੋਈ ਨੋਨ ਆ ਥੋੜ੍ਹਾ ਦੱਸਿਓ ਇਸ ਸਕੂਲ ਦੀ ਡਿਟੇਲ ਬਾਰੇ ਅੱਛਾ ਅੱਛੀ ਸੀ ਬੀ ਐਸ ਈ ਪੈਟਰਨ ਹੈ ਫਿਰ ਤਾਂ ਠੀਕ ਹੈ ਨਹੀਂ ਉਹ ਮਿਊਜਿਕ ਪ੍ਰੋਪਰ ਉੱਥੇ ਪੀਰੀਅਡ ਲੱਗਦਾ ਵਾ ਇਹਨਾਂ ਆਪਸ਼ਨਲ ਹੀ ਹੈ ਅੱਛਾ ਉਹ ਮੈਂ ਵੀ ਉੱਥੇ ਫੇਸਬੁੱਕ ਦੇ ਵਿੱਚ ਦੇਖਿਆ ਸੀ ਐਚੂਅਲੀ ਉਹਦੇ ਬਾਰੇ ਕਿ ਉਹ ਬੱਚੇ ਜਿਹੜੇ ਆ ਉਹ ਪਾਠ ਵਗੈਰਾ ਵੀ ਕਰਦੇ ਆ ਸਵੇਰੇ ਅਰਦਾਸ ਵਗੈਰਾ ਹੁੰਦੀ ਉਹੀ ਸਕੂਲ ਲੱਗਦਾ ਮੈਨੂੰ ਨਾਮ ਤਾਂ ਨਹੀਂ ਪਤਾ ਬਟ ਮੈਨੂੰ ਪਤਾ ਹੈਗਾ ਅੱਛਾ ਚਲੋ ਠੀਕ ਆ ਫਿਰ ਹਾਂ ਇਹਦੇ ਬਾਰੇ ਹਾਂ ਫਿਰ ਡਿਸਕਸ ਕਰ ਲਵਾਂਗੇ ਫਿਰ ਮੇਰੇ ਮੇਰੇ ਵੱਲੋਂ ਵੀ ਇਹੀ ਠੀਕ ਹੈ ਠੀਕ ਹੈ ਓਕੇ ਜੀ ਓਕੇ ਓਕੇ